ਸਾਡੇ ਖਿਆਲ ਵਿੱਚ ਕਈ ਲੋਕ ਡਾਂਸ ਨੂੰ ਨਿਯਮਬੱਧ ਸਮਝਦੇ ਹਨ ਉਹਨਾਂ ਅਨੁਸਾਰ ਡਾਂਸ ਦੇ ਕਈ ਨਿਯਮ ਹੁੰਦੇ ਹਨ ਪਰ ਅਸਲ ਵਿੱਚ ਡਾਂਸ ਮਨ ਦੀ ਖੁਸ਼ੀ ਦਾ ਪ੍ਰਗਟਾਵਾ ਹੁੰਦਾ ਹੈ ਡਾਂਸ ਕਈ ਖੁਸ਼ੀ ਦੇ ਮੌਕਿਆਂ 'ਤੇ ਕੀਤਾ ਜਾਂਦਾ ਹੈ ਪਰ ਕਈ ਲੋਕ ਡਾਂਸ ਨੂੰ ਕੇਵਲ ਮਨੋਰੰਜਨ ਦਾ ਸਾਧਨ ਮੰਨਦੇ ਹਨ ਪਰ ਡਾਂਸ ਤਾਂ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਜ਼ਰੂਰੀ ਅੰਗ ਹੁੰਦਾ ਹੈ